ਸਤਿ ਸ਼੍ਰੀ ਅਕਾਲ ਸਰ ਮੈਂ ਮੀਨਾਕਸ਼ੀ ਪਠਾਨਕੋਟ ਤੋਂ ਬੋਲ ਰਹੀ ਹਾਂ ਅਤੇ ਮੈਨੂੰ ਸਾਈਕਲ ਚਲਾਉਣ ਦਾ ਬਹੁਤ ਹੀ ਸ਼ੌਂਕ ਹੈ ਮੈਂ ਸਕੂਲ ਵੀ ਸਾਈਕਲ 'ਤੇ ਹੀ ਜਾ ਜਾਂਦੀ ਹਾਂ ਅਤੇ ਜਿਸ ਕਾਰਣ ਸਾਈਕਲ ਚਲਾਉਣ ਵੇਲੇ ਸਾਨੂੰ ਕਈ ਤਰ੍ਹਾਂ ਦੀਆਂ ਸਮੱਸਿਆ ਆਉਂਦੀਆਂ ਹਨ ਅਤੇ ਕਈ ਤਰ੍ਹਾਂ ਦੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਮੈਂ ਆਪਣੇ ਸਾਈਕਲ ਨਾਲ ਇੱਕ ਛੋਟਾ ਜਿਹਾ ਡੱਬਾ ਲਗਾਇਆ ਹੈ ਜਿਸ ਵਿੱਚ ਜ਼ਰੂਰਤ ਦਾ ਸਾਰਾ ਮੈਂ ਸਮਾਨ ਰੱਖਿਆ ਹੁੰਦਾ ਕਿ ਬਾਹਰ ਜਾਣ ਵੇਲੇ ਕਈ ਤ ਤਰ੍ਹਾਂ ਦੀ ਚੀਜ਼ਾਂ ਦੀਆਂ ਲੋੜ ਪੈ ਸਕਦੀ ਹੈ ਜਿਵੇਂ ਕਿ ਕੋਈ ਕੋਈ ਜਿਵੇਂ ਕਿ ਫਰਸਟ ਏਡ ਬਾਕਸ ਰਾਹ ਵਿੱਚ ਜੇਕਰ ਕਿਸੇ ਦੇ ਕੋਈ ਸੱਟ ਫੇਟ ਲੱਗੀ ਹੋਏ ਤਾਂ ਉਸਦੀਆਂ ਉਸਦੀ ਇਹ ਮਦਦ ਕੀਤੀ ਜਾਵੇ ਕਿ ਪੱਟੀ ਵਗੈਰਾ ਬੈਂਡੇਜ ਦਵਾਈ ਵਗੈਰਾ ਆਦਿ ਜਿਸ ਵਿੱਚ ਮੈਂ ਰੱਖੀ ਹੁੰਦੀ ਹੈ ਅਤੇ ਸਾਨੂੰ ਸਾਈਕਲ ਵੀ ਪੈਡ ਵਗੈਰਾ ਅਤੇ ਹੈਲਮਟ ਲਗਾ ਕੇ ਚਲਾਉਣਾ ਚਾਹੀਦਾ ਹੈ ਕਿ ਆਪਣੀ ਪੂਰੀ ਸੇਫਟੀ ਦਾ ਧਿਆਨ ਰੱਖਣਾ ਚਾਹੀਦਾ ਤਾਂ ਜੋ ਸਾ ਸਾਡੀ ਜਾਨ ਨੂੰ ਅਤੇ ਅਗਲੇ ਦੀ ਜਾਨ ਨੂੰ ਕੋਈ ਖ਼ਤਰਾ ਨਾ ਹੋਵੇ ਅਤੇ ਸਾਈਕਲ ਚਲਾਉਣ ਮਿਲੇ ਸਾਨੂੰ ਸਾਰਿਆਂ ਨਿਯਮਾਂ ਦਾ ਪਾਲ ਨਿਯਮ ਦੀ ਪਾਲਣਾ ਕਰਨੀ ਚਾਹੀਦੀ ਹੈ